ਜਿਵੇਂ ਕਿ ਮੈਂ ਹਮੇਸ਼ਾ ਹੀ ਕਹਿੰਦਾ ਸਾਹਿਤਯ ਕੋਈ ਵੀ ਉਹਦੇ 'ਚ ਦੋ ਮੁੱਖ ਮੈਨੂੰ ਅਤੇ ਅਸੀਂ ਪਿੱਲਰ ਅਸੀਂ ਕਹਿ ਲਈਏ ਲੱਗਦੇ ਨੇ ਉਹ ਸਾਹਿਤਯ ਦੇ ਉਹ ਨੇ ਪਿਆਰ ਅਤੇ ਪਿਆਰ ਲਈ ਕੁਰਬਾਨੀ ਕੋਈ ਵੀ ਸਾਹਿਤਯ ਲੈ ਲਓ ਤੁਸੀਂ ਚਾਹੇ ਉਹ ਪੰਜਾਬ ਦਾ ਆਪਣਾ ਖੇਤਰੀ ਸਾਹਿਤਯ ਹੈ ਜਾਂ ਭਾਰਤੀ ਸਾਹਿਤਯ ਹੈ ਜਾਂ ਕਿਸੇ ਹੋਰ ਤੁਸੀਂ ਦੇਸ਼ ਦਾ ਖੇਤਰ ਦਾ ਦੇਖੋਗੇ ਬੇਸ ਜਿਹੜਾ ਦਿਖੇਗਾ ਉਹ ਇਹਨਾਂ 'ਚੋਂ ਬਹੁਤ ਜ਼ਿਆਦਾ ਚਾਂਸਿਸ ਨੇ ਕਿ ਇਹ ਦੋ ਚੀਜ਼ਾਂ ਹੀ ਹੋਣਗੀਆਂ ਪਿਆਰ ਅਤੇ ਪਿਆਰ ਲਈ ਕੁਰਬਾਨੀ ਹੁਣ ਇਹ ਕਿੱਦਾਂ ਦੱਸ ਸਕਦਾ ਤੁਹਾਨੂੰ ਸਾਬਿਤ ਕਰ ਦਿੰਦਾ ਜੇ ਆਪਾਂ ਇੰਡੀਅਨ ਲਿਟਰੇਚਰ ਦੀ ਗੱਲ ਕਰੀਏ ਭਾਰਤੀ ਸਾਹਿਤ ਦੀ ਗੱਲ ਕਰ ਲਈਏ ਸਭ ਤੋਂ ਵੱਡਾ ਜਿਹੜਾ ਸਾਡਾ ਸਾਹਿਤਯ ਕਿਤਾਬ ਹੈਗੀ ਹੈ ਰਮਾਇਣ ਉਹਨੂੰ ਜੇ ਅਸੀਂ ਉਹਦਾ ਸਾਰ ਕੱਢੀਏ ਸੋ ਕੀ ਨਿਕਲ ਕੇ ਆਉਂਦਾ ਰਾਮ ਚੰਦਰ ਜੀ ਨੇ ਬਨਵਾਸ ਕੀਤਾ ਕਿਹਦੇ ਲਈ ਲਿਆ ਆਪਣੇ ਪਿਤਾ ਦੇ ਪ੍ਰੇਮ ਲਈ ਉਹਦੇ ਵਾਸਤੇ ਕੁਰਬਾਨੀ ਦਿੱਤੀ ਰਾਜਭਾਗ ਛੱਡਿਆ ਅਤੇ ਜਾ ਕੇ ਆਪਣਾ ਜੰਗਲ 'ਚ ਰਹਿਣਾ ਸ਼ੁਰੂ ਕਰਤਾ ਅੱਗੇ ਚੱਲ ਪਓ ਰਾਵਣ ਨੂੰ ਮਾਰਿਆ ਕਿਉਂ ਮਾਰਿਆ ਆਪਨੇ ਪਿਆਰ ਲਈ ਸੀਤਾ ਲਈ ਜਿਹੜਾ ਪਿਆਰ ਰਾਜ ਜੀ ਚੰਦਰ ਜੀ ਨੇ ਉਸ ਪਿਆਰ ਵਾਸਤੇ ਆਪਣਾ ਸਭ ਕੁਝ ਦਾਅ 'ਤੇ ਲਾ ਕੇ ਉਥੇ ਪਹੁੰਚੇ ਸੀ ਲ ਲੰਕਾ ਤੱਕ ਜਾ ਕੇ ਰਾਵਣ ਤੱਕ ਉਸ ਤੋਂ ਬਾਅਦ ਜੋ ਅਸੀਂ ਟੀਵੀ 'ਤੇ ਦੇਖਿਆ ਦੇਖੋ ਉਹਦੇ ਹਿਸਾਬ ਨਾਲ ਹੀ ਜੇ ਗੱਲ ਕਰੀਏ ਕਹਿੰਦੇ ਜੀ ਮਾਤਾ ਸੀਤਾ ਵਾਪਸ ਮਹਾਂ ਰਿਸ਼ੀ ਬਾਲਮੀਕੀ ਜੀ ਦੇ ਕੋਲ ਜਾ ਕੇ ਰਹੇ ਨੇ ਕੁਝ ਕਾਰਨਾਂ ਕਰਕੇ ਅਤੇ ਉਹਨਾਂ ਨੇ ਵੀ ਤਿਆਗ ਕੀਤਾ ਕਾਹਦਾ ਤਿਆਗ ਪਿਆਰ ਦੇ ਬੇਸ 'ਤੇ ਅਯੋਧਿਆ ਦੇ ਲੋਕਾਂ ਨਾਲ ਉਹਨਾਂ ਦਾ ਪਿਆਰ ਸੀ ਉਹਨਾਂ ਵਾਸਤੇ ਆਪਣੇ ਪਤੀ ਰਾਮ ਚੰਦਰ ਜੀ ਦੇ ਮਾਨ ਸਨਮਾਨ ਵਾਸਤੇ ਓਦਾਂ ਹੀ ਪੰਜਾਬ ਦੇ ਸਹਿਤਯ ਦੀ ਗੱਲ ਕਰੀਏ ਤਾਂ ਸੱਸੀ ਪੁੰਨੂੰ ਸੋਨੀ ਮਹੀਵਾਲ ਹੀਰ ਰਾਂਝਾ ਇਹ ਸਭ ਕੀ ਨੇ ਇਹ ਸਭ ਨੇ ਕੀ ਕੀਤਾ ਕੁਰਬਾਨੀ ਦਿੱਤੀ ਕਾਹਦੀ ਕਿਉਂ ਪਿਆਰ ਉਹਦੇ ਵਾਸਤੇ ਇਹ ਸੱਸੀ ਪੰਨੂੰ ਹੋਗੇ ਜੇ ਅਸੀੰ ਆਪਣੇ ਪੰਜਾਬ ਦੇ ਬੇਸ 'ਤੇ ਗੱਲ ਕਰ ਲਈਏ ਪੰਜਾਬੀਅਤ ਦੇ ਬੇਸ ਦੀ ਗੱਲ ਕਰ ਲਈਏ ਸਾਡੇ ਗੁਰੂ ਸਾਹਿਬਾਨਾਂ ਨੇ ਕੁਰਬਾਨੀ ਦਿੱਤੀ ਕਿਉਂ ਦਿੱਤੀ ਕਿਉਂਕਿ ਉਹਨਾਂ ਨੂੰ ਪਿਆਰ ਸੀ ਧਰਮ ਨਾਲ ਧਰਮ ਦੀ ਰਾਖੀ ਲਈ ਧਰਮ ਦੇ ਪ੍ਰਚਾਰ ਲਈ ਉਹਨਾਂ ਨੇ ਕੁਰਬਾਨੀ ਦਿੱਤੀ ਉਹ ਪਿਆਰ ਹੀ ਸੀ ਉਹ ਪਿਆਰ ਅਤੇ ਪਿਆਰ ਦੀ ਕੁਰਬਾਨੀ ਦੇਖੋ ਇਹ ਜਿੱਥੇ ਪਿਆਰ ਪਿਆਰ ਦੀ ਕੁਰਬਾਨੀ ਆ ਪਿਆਰ ਵਾਸਤੇ ਕੁਰਬਾਨੀ ਆਊਗੀ ਉੱਥੇ ਸਾਹਿਤਯ ਮਿਲੂਗਾ ਔਰ ਜਿਹੜਾ ਵੀ ਸਾਹਿਤਯ ਦੇ ਵਿੱਚ ਦੋ ਚੀਜ਼ਾਂ ਹੋਣਗੀਆਂ ਉਹ ਆਪਸ 'ਚ ਜੁੜੇ ਹੋਏ ਨੇ ਦੋਵੇਂ ਸਾਈਡ 'ਤੇ ਦੇਖੇ ਦੋਨਾਂ ਦੇ ਵਿੱਚ ਪਿਆਰ ਅਤੇ ਪਿਆਰ ਲਈ ਕੁਰਬਾਨੀ ਹੀ ਹੈ ਅਤੇ ਮੇਰੇ ਹਿਸਾਬ ਨਾਲ ਇਹ ਦੋਨਾਂ ਦਾ ਇੱਕ ਦੂਜੇ ਦੇ ਉੱਤੇ ਬਹੁਤ ਗਹਿਰਾ ਅਸਰ ਰਹਿੰਦਾ ਚਾਹੇ ਕੋਈ ਵੀ ਰੀਜਨਲ ਜਾਂ ਖੇਤਰੀ ਆਪਣਾ ਸਾਹਿਤ ਹੋਵੇ ਅਤੇ ਭਾਰਤੀ ਸਾਹਿਤ ਕੋਈ ਵੀ ਪੰਜਾਬ ਨੂੰ ਛੱਡ ਕੇ ਬਾਹਰਲਾ ਵੀ ਕੋਈ ਦੇਖੋਗੇ ਰਾਜਸਥਾਨ ਦਾ ਜਾਂ ਜੰਮੂ ਕਸ਼ਮੀਰ ਦਾ ਹਿਮਾਚਲ ਸਭ ਦਾ ਆਪਣਾ ਆਪਣਾ ਇੱਕ ਰੋਲ ਹੈਗਾ ਹਿੰਦੁਸਤਾਨ ਦੇ ਆਪਣੇ ਸਾਹਿਤਯ ਨੂੰ ਬਣਾਉਣ ਲਈ